ਮੈਂ ਅਤੇ ਮੇਰਾ ਪਰਿਵਾਰ ਸਾਡੇ ਨਾਲ ਦੇ ਲਾਗੇ ਪਿੰਡਾਂ ਦਾ ਦੌਰਾ ਜਾਂ ਉੱਥੇ ਅਸੀਂ ਅਕਸਰ ਜਾਂਦੇ ਰਹਿੰਦੇ ਹਾਂ ਤਾਂ ਆਪਾਂ ਉਸ ਚੀਜ਼ ਨੂੰ ਗਿਣ ਨਹੀਂ ਸਕਦੇ ਬਟ ਜਿਹੜੇ ਦੂਰਲੇ ਪਿੰਡਾਂ ਤਾਂ ਉਹਨਾਂ ਦਾ ਹੈ ਹੁੰਦਾ ਵੀ ਮਹੀਨੇ ਜਾਂ ਦੋ ਮਹੀਨੇ 'ਚ ਇੱਕ ਅੱਧੀ ਵਾਰ ਗੇੜਾ ਮਾਰ ਏ ਆਉਂਦੇ ਹਾਂ ਪਹਿਲੀ ਗੱਲ ਵੀ ਆਪਾਂ ਨੂੰ ਆਪਣੇ ਕਲਚਰ ਨਾਲ ਜੁੜਨ ਦਾ ਮੌਕਾ ਮਿਲਦਾ ਕਿਉਂਕਿ ਅੱਜ ਕੱਲ੍ਹ ਚਾਹੇ ਸ਼ਹਿਰ ਛੋਟਾ ਚਾਹੇ ਵੱਡਾ ਅਤੇ ਆਪਾਂ ਨੂੰ ਆਪਾਂ ਆਪਣੇ ਜੋ ਕਲਚਰ ਆ ਉਹ ਤੋਂ ਵਿਛੜਦੇ ਜਾ ਰਹੇ ਹਾਂ ਆਪਾਂ ਵੈਸੇ ਮੋਡਰਨ ਚੀਜ਼ਾਂ ਨੂੰ ਅਪਣਾਈ ਜਾ ਰਹੇ ਹਾਂ ਲੇਕਿਨ ਆਪਾਂ ਆਪਣਾ ਕਲਚਰ ਭੁੱਲਦੇ ਜਾ ਰਹੇ ਹਾਂ ਸੋ ਪਿੰਡ ਆਪਾਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਦਾ ਪਹਿਲੀ ਗੱਲ ਅਤੇ ਉੱਥੇ ਜਿਵੇਂ ਸਾਰੇ ਪੁਰਾਣੇ ਡਿਜ਼ਾਈਨ ਹੋ ਗਏ ਘਰਾਂ ਦੇ ਹਵੇਲੀ ਆ ਕੋਠੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਹੈ ਨਾ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਦੂਜੀ ਗੱਲ ਸ਼ਹਿਰਾਂ 'ਚ ਅੱਜ ਕੱਲ੍ਹ ਚਾਹੇ ਉਹ ਬੱਚੇ ਦੀਆਂ ਖਾਣ ਦੀਆਂ ਚੀਜ਼ਾਂ ਹੋਣ ਦੁੱਧ ਹੋਵੇ ਮਿੱਠਾ ਹੋਵੇ ਹੈ ਨਾ ਉਰੇ ਤੱਕ ਕਿ ਸਬਜ਼ੀਆਂ ਵੀ ਹਾਲਾਂਕਿ ਜੋ ਖੇਤੀਬਾੜੀ ਦਾ ਕੇਂਦਰ ਹੈ ਉਹਦੇ 'ਚ ਵੀ ਪੈਸਟੀਸਾਈਡਸ ਦਾ ਇੰਨਾਂ ਕੁ ਜ਼ਿਆਦਾ ਯੂਜ ਹੋਣ ਲੱਗ ਗਿਆ ਕਿ ਸ਼ਹਿਰਾਂ 'ਚ ਸਬ ਬੰਦਾ ਆਮ ਸਬਜ਼ੀ ਜਾਂ ਫਲ ਫਰੂਟ ਵੀ ਨਹੀਂ ਖਰੀਦ ਕੇ ਖਾ ਸਕਦਾ ਮਿਲਾਵਟ ਨਾਲ ਭਰੀਆਂ ਪਈਆਂ ਚੀਜ਼ਾਂ ਸੋ ਇੱਕ ਇਹ ਵੀ ਫਾਇਦਾ ਹੋ ਜਾਂਦਾ ਵੀ ਜੇ ਤੁਹਾਡਾ ਪਿੰਡ ਜੇ ਤੁਸੀਂ ਪਿੰਡ ਜਾਂਦੇ ਹੋ ਉੱਥੇ ਇੰਨਾਂ ਪੈਸਟੀਸਾਈਡਸ ਦਾ ਯੂਜ ਨਹੀਂ ਹੁੰਦਾ ਤਾਂ ਕਰਕੇ ਆਪਾਂ ਨੂੰ ਸ਼ੁੱਧ ਦੇਸੀ ਚੀਜ਼ਾਂ ਮਿਲ ਸਕਦੀਆਂ ਨੇ ਆਪਾਂ ਖਰੀਦ ਸਕਦੇ ਹਾਂ ਅਤੇ ਇਹਦੇ ਨਾਲ ਉਹਨਾਂ ਦਾ ਵੀ ਰੁਜ਼ਗਾਰ ਹੈ ਜੋ ਪਿੰਡਾਂ ਵਾਲਿਆਂ ਦਾ ਉਹ ਵੀ ਵੱਧਦਾ ਵਾਧਾ ਹੁੰਦਾ ਉਹਨਾਂ ਦੀ ਵੀ ਰੋਟੀ ਰੋਜੀ ਚਲਦੀ ਹੈ ਇਸ ਚੀਜ਼ ਨਾਲ ਤੀਜਾ ਕੀ ਆਪਾਂ ਨੂੰ ਜਿਵੇਂ ਕਿ ਸ਼ਹਿਰਾਂ 'ਚ ਤਾਂ ਬਹੁਤ ਘੱਟ ਬਜ਼ੁਰਗ ਉਹ ਰਹਿੰਦੇ ਨੇ ਮਤਲਬ ਜੇ ਇੱਕ ਟੱਬਰ ਹੈ ਤਾਂ ਉਹ ਟੱਬਰ ਛੋਟਾ ਟੱਬਰ ਹੁੰਦਾ ਇੱਕ ਜੁਆਇੰਟ ਜਾਂ ਵੱਡਾ ਟੱਬਰ ਨਹੀਂ ਹੁੰਦਾ ਅਤੇ ਕਈ ਵਾਰੀ ਬਜ਼ੁਰਗ ਵੀ ਨਹੀਂ ਹੁੰਦੇ ਉਸ ਟੱਬਰ 'ਚ ਬਜ਼ੁਰਗ ਅੱਡ ਘਰ 'ਚ ਰਹਿੰਦੇ ਹੁੰਦੇ ਅਤੇ ਛੋਟੇ ਅੱਡ 'ਚ ਤਾਂ ਕਰਕੇ ਪਿੰਡਾਂ ਪਿੰਡਾਂ 'ਚ ਜੇ ਆਪਾਂ ਜਾਂਦੇ ਤਾਂ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਕਿ ਸਾਰਾ ਪਰਿਵਾਰ ਇੱਕ ਹੋ ਕੇ ਰਹਿੰਦਾ ਚਾਹੇ ਉਹ ਬਜ਼ੁਰਗ ਨੇ ਚਾਹੇ ਬੱਚੇ ਨੇ ਚਾਹੇ ਅੱਗੇ ਬੱਚਿਆਂ ਦੇ ਬੱਚੇ ਨੇ ਤਾਂ ਆਪਾਂ ਨੂੰ ਉਹਨਾਂ ਤੋਂ ਵੀ ਸਿੱਖਿਆ ਮਿਲਦੀ ਹੈ ਵੀ ਪਹਿਲਾਂ ਦਾ ਟਾਈਮ ਕਿਵੇਂ ਦਾ ਹੁੰਦਾ ਸੀ ਕਿਵੇਂ ਆਪਾਂ ਨੂੰ ਵਰਤਣਾ ਚਾਹੀਦਾ ਇੱਕ ਦੂਜੇ ਨਾਲ ਤਾਂ ਆਪਾਂ ਨੂੰ ਬਹੁਤ ਚੀਜ਼ਾਂ ਪਿੰਡ ਤੋਂ ਸਿੱਖਣ ਨੂੰ ਮਿਲਦੀਆਂ ਨੇ